ਭਾਰਤ ਇੱਕ ਵੱਧਦੀ ਹੋਈ ਇਕੋਨਮੀ ਵਾਲਾ ਦੇਸ਼ ਹੈ ਜਿਸ ਕਾਰਨ ਭਾਰਤ ਵਿੱਚ ਪੋਲਿਊਸ਼ਨ ਦੀ ਮਾਤਰਾ ਵੀ ਬਹੁਤ ਵੱਧਦੀ ਜਾ ਰਹੀ ਹੈ ਕਿ ਜਿਸ ਦਾ ਮੁੱਖ ਕਾਰਨ ਵੱਧਦੀ ਹੋਈ ਆਬਾਦੀ ਵੀ ਹੈ ਵੱਧਦੀ ਹੋਈ ਆਬਾਦੀ ਕਾਰਨ ਲੋਕ ਕਮਾਈ ਵੀ ਵੱਧ ਕਰ ਰਹੇ ਹਨ ਜਿਸ ਕਾਰਨ ਲੋਕ ਪ੍ਰ ਹਵਾ ਨੂੰ ਪ੍ਰਦੂਸ਼ਿਤ ਵੀ ਬਹੁਤ ਕਰ ਰਹੇ ਹਨ ਜਿਵੇਂ ਲੋਕ ਪੇੜ ਪੌਦੇ ਕੱਟ ਕੇ ਆਪਣੇ ਘਰ ਵਸਾ ਲੈਂਦੇ ਹਨ ਉਸ ਨਾਲ ਵੀ ਪ੍ਰਦੂਸ਼ਣ ਪੈਦਾ ਹੁੰਦਾ ਹੈ ਜਿਵੇਂ ਲੋਕ ਗੱਡੀਆਂ ਮੋਟਰਸਾਈਕਲ ਬਾਈਕਾਂ ਲੈ ਕੇ ਫ ਧੁਨੀ ਪ੍ਰਦੂਸ਼ਣ ਕਰਦੇ ਹਨ ਅਤੇ ਉਹ ਦੇ ਨਾਲ ਵੀ ਏਅਰ ਪ੍ਰਣਾਲੀ ਵੀ 'ਤੇ ਵੀ ਫ਼ਰਕ ਪੈਂਦਾ ਹੈ ਪੰ ਇੰਡੀਆ ਵਿੱਚ ਜਾਂ ਭਾਰਤ ਵਿੱਚ ਸਭ ਤੋਂ ਵੱਧ ਏਅਰ ਪ੍ਰਣਾਲੀ ਦੁਆਰਾ ਦੇਸ਼ ਏਅਰ ਪ੍ਰਣਾਲੀ ਵਾਲੀ ਸਿਟੀ ਜਾਂ ਫਿਰ ਏਰੀਆ ਦਿੱਲੀ ਹੈ ਜਿਸ ਵਿੱਚ ਬਹੁਤ ਮਾਤਰਾ ਵਿੱਚ ਪੋਲਿਊਸ਼ਨ ਪੈਦਾ ਹੁੰਦਾ ਹੈ ਇਸ ਵਿੱਚ ਦੋ ਸਾਲ ਵਿੱਚ ਕਈ ਵਾਰੀ ਸਰਕਾਰ ਆਪ ਮੀਂਹ ਵੀ ਪਵਾਉਂਦੀਆਂ ਹਨ ਜਿਸ ਰਾਹੀਂ ਪੋਲਿਊਸ਼ਨ ਵੀ ਘੱਟਦਾ ਹੈ ਅਤੇ ਹਵਾ ਥੋੜ੍ਹੀ ਸ਼ੁੱਧ ਹੋ ਜਾਂਦੀ ਹੈ ਜਿਸ ਕਾਰਨ ਇਸ ਲਈ ਭਾਰਤ ਇੱਕ ਪ੍ਰਦੂਸ਼ਿਤ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ